ਮੇਰੇ ਪਸੰਦੀਦਾ ਗਾਣਿਆਂ ਵਿੱਚ ਗਾਇਕ ਰਣਜੀਤ ਕੌਰ ਦਾ ਗਾਣਾ ਨਾਨਕ ਵੀਰਾ ਮੈਂ ਤੈਨੂੰ ਘੋੜੀ ਚੜੀਨੀ ਆ ਅਤੇ ਗੁਰਦਾਸ ਮਾਨ ਜੀ ਦਾ ਗਾਣਾ ਸਰਬੰਸਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਇਸੇ ਤਰ੍ਹਾਂ ਸੁਰਿੰਦਰ ਸ਼ਿੰਦਾ ਜੀ ਦਾ ਗਾਣਾ ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਇਸੇ ਤਰ੍ਹਾਂ ਨਛੱਤਰ ਗਿੱਲ ਜੀ ਦਾ ਗੀਤ ਮੈਂ ਵਾਰੇ ਜਾਵਾਂ ਸਾਹਿਬ ਜਿਹਨਾਂ ਦੀਆਂ ਮੰਨੇ ਇਸੇ ਤਰ੍ਹਾਂ ਹਰਜੀਤ ਹਰਮਨ ਜੀ ਦਾ ਗੀਤ ਜਿੱਥੋਂ ਮਰਜ਼ੀ ਵੰਗਾਂ ਚੜਵਾ ਲਈ ਨੀ ਮਿੱਤਰਾਂ ਦਾ ਨਾਂ ਚੱਲਦਾ ਇਸੇ ਤਰ੍ਹਾਂ ਮਨਮੋਨ ਵਾਰਸ ਜੀ ਦਾ ਗੀਤ ਜੱਗੇ ਜੱਟ ਦਾ ਬਠਿੰਡੇ ਵਾਲਾ ਡਾਕਾ ਆਦਿ ਇਹ ਸੁਣਨੇ ਨੂੰ ਮੈਂ ਪਹਿਲ ਦਿੰਦਾ ਹਾਂ ਜਿਸ ਵਿੱਚ ਘਾਰੇ ਘਰੇਲੂ ਡੈੱਕ ਰਾਹੀਂ ਫ਼ੋਨ ਰਾਹੀਂ ਗੱਡੀ ਚਲਾਉਂਦਿਆਂ ਹੋਇਆਂ ਜਾਂ ਕਿਤੇ ਵੀ ਜਿੱਥੇ ਵੀ ਮੌਕਾ ਮਿਲੇ ਉੱਥੇ ਮੈਂ ਆਪਣੇ ਇਹਨਾਂ ਮਨ ਪਸੀਨਾ ਮਨਪਸੰਦੀਦਾ ਗਾਣਿਆਂ ਨੂੰ ਸੁਣਨਾ ਪਸੰਦ ਕਰਦਾ ਹਾਂ